ਕਲਾ ਜਗਤ ਵਿੱਚ ਨਵੀਨਤਮ ਤਕਨੀਕ ਅਤੇ ਰੋਜਿਆਦਾ ਰੋਜ਼ਾਨਾ ਦੇ ਨਾਲ ਸਾਨੂੰ ਅਪਡੇਟ ਰਹਿਣ ਲਈ ਵੱਖ ਵੱਖ ਤਰੀਕਿਆਂ ਨੂੰ ਅਪਣਾਉਣਾ ਜਾਂਦਾ ਹੈ ਸਭ ਤੋਂ ਪਹਿਲਾਂ ਆਰਟ ਅਤੇ ਡਿਜੀਟਲ ਮੀਡੀਆ ਨਾਲ ਜੁੜੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਲੈਣ ਲਈ ਔਨਲਾਈਨ ਪਲੈਟਫਾਰਮ ਜਿਵੇਂ ਕਿ ਸੋਸ਼ਲ ਮੀਡੀਆ ਆਰਟ ਗੈਲਰੀਆਂ ਹੋ ਗਈਆਂ ਵੈਬਸਾਈਟਾਂ ਹੋ ਗਈਆਂ ਕਲਾ ਕੇਂਦਰ ਹੋ ਗਏ ਵਲੋਗਸ ਹੋ ਗਏ ਦੂਜੀਆਂ ਤਕਨੀਕਾਂ ਜਿਵੇਂ ਕਿ ਡਿਜੀਟਲ ਪੇਂਟਿੰਗ ਹੋ ਗਈ ਥਰੀ ਡੀ ਮੋਡਲਿੰਗ ਹੋ ਗਈ ਧਿਆਨ ਦੇਣਾ ਵੀ ਜ਼ਰੂਰੀ ਹੁੰਦਾ ਆ ਅਤੇ ਜੋ ਆਧੁਨਿਕ ਰੁਝਾਨਾਂ ਨਾਲ ਲੱਗੇ ਰਹਿ ਸਕੀਆਂ ਇਸ ਦੇ ਨਾਲ ਸਾਨੂੰ ਆਰਟ ਵਰਕਸ਼ਾਪਵਾਂ ਕੌਂਸਲ ਵਿੱਚ ਸ਼ਾਮਿਲ ਹੋਣਾ ਨਵੇਂ ਆਰਟਿਸ ਅਤੇ ਕਲੈਕਸ਼ਨ ਦੀ ਪੜਤਾਲ ਕਰਨਾ ਵੀ ਮਦਦਗਾਰ ਹੁੰਦਾ ਹੈ ਵਾਤਾਵਤ ਵਾਤਾਵਰਨ ਅਤੇ ਸਮਾਜਿਕ ਬਦਲਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਕਲਾਕਾਰ ਨੂੰ ਨਵੇਂ ਵਿਚਾਰ ਨਵੇਂ ਰੁਝਾਨ ਆਪਣੇ ਕੰਮ ਵਿਚ ਸ਼ਾਮਿਲ ਕਰਨੇ ਚਾਹੀਦੇ ਆ ਜਿਸ ਨਾਲ ਉਹ ਸਗੋਂ ਨਵੀਆਂ ਤਕਨੀਕਾਂ ਦੇ ਨਾਲ ਆਪਣੇ ਆਪ ਨੂੰ ਸਵੀਕਾਰ ਕਰਦਾ ਹੈ ਸਗੋਂ ਆਪਣੀ ਕਲਾ ਨੂੰ ਵੀ ਲੈ ਕੇ ਉਹ ਨਵੇਂ ਪੱਧਰ 'ਤੇ ਨਵੇਂ ਪੱਧਰ 'ਤੇ ਲੈ ਜਾਂਦਾ ਹੈ ਇਸ ਨਾਲ ਉਸਨੂੰ ਆਪਣੀ ਕਲਾ ਦੇ ਬਾਰੇ ਨਵੀਂ ਨਵੀਂ ਚੀਜ਼ਾਂ ਪਤਾ ਲੱਗਦੀਆਂ ਹਨ ਆ ਜਿਵੇਂ ਕਿ ਅੱਜ ਵਾਲੀ ਟੈਕਨੋਲੋਜੀ ਨੂੰ ਲੈ ਕੇ ਆਪਾਂ ਚੱਲਦੇ ਹਾਂ ਜਿਵੇਂ ਕਿ ਅੱਜ ਵਾਲੀ ਟੈਕਨੋਲਜੀ ਦੇ ਨਾਲ ਸਾਨੂੰ ਵੀ ਆਪਣੀ ਕਲਾ ਜਗਤ ਵਿੱਚ ਨਵੀਨਤਮ ਤਕਨੀਕਾਂ ਯੂਜ਼ ਕਰਨੀਆਂ ਚਾਹੀਦੀਆਂ ਹੈ ਸਾਨੂੰ ਵੱਖ ਵੱਖ ਇਨਫਲੁਐਸਾਂ 'ਚ ਜਾਣਾ ਚਾਹੀਦਾ ਹੈ ਵਰਕਸ਼ਾਪਾਂ 'ਤੇ ਜਾਣਾ ਚਾਹੀਦਾ ਹੈ ਤਾਂ ਕਿ ਸਾਨੂੰ ਆਪਣੇ ਕਲਾ ਜੀਵਨ ਦੇ ਵਿੱਚ ਪਤਾ ਲੱਗੇ ਕੀ ਹੈ ਕਲਾ ਵਿੱਚ ਕੀ ਕੀ ਹੋ ਰਿਹਾ ਹੈ ਇਸ ਲਈ ਸਾਨੂੰ ਆਪਣੇ ਆਪ ਨੂੰ ਅਪਡੇਟ ਰੱਖਣ ਲਈ ਸਾਨੂੰ ਇਹ ਚੀਜ਼ਾਂ ਆਪਣੇ ਲਾਈਫ 'ਚ ਜ਼ਿੰਦਗੀ 'ਚ ਪਤਾ ਕਰਨੀਆਂ ਚਾਹੀਦੀਆਂ